ਜੀ ਹਾਂ ਮੈਂ ਬੈਂਕਿੰਗ ਦਸਤਾਵੇਜ਼ਾਂ ਨੂੰ ਆਪਣੀ ਖੇਤਰੀ ਭਾਸ਼ਾ ਵਿੱਚ ਉਪਲਬਧ ਕਰਵਾਉਣਾ ਪਸੰ ਪਸੰਦ ਕਰਾਂਗਾ ਕਿਉਂਕਿ ਜਿਸ ਕਾਰਨ ਸਾਡੇ ਪ ਅਨਪੜ੍ਹ ਲੋਕ ਜਾਂ ਫਿਰ ਘੱਟ ਪੜ੍ਹੇ ਲਿਖੇ ਲੋਕ ਅਪਣੀ ਪੰਜਾਬੀ ਭਾਸ਼ਾ ਵਿੱਚ ਦਸਤਾ ਬੈਂਕਿੰਗ ਦਸਤਾਵੇਜ਼ਾਂ ਨੂੰ ਭਰ ਸਕਦੇ ਹਨ ਕਿਉਂਕਿ ਜਿਹੜੇ ਅਸੀਂ ਹਾਂ ਤਾਂ ਅਸੀਂ ਸਾਰੀ ਭਾਸ਼ਾ ਬੋਲ ਲੈਂਦੇ ਹਨ ਪਰ ਜਿਹੜੇ ਬਜ਼ੁਰਗ ਜਾਂ ਫਿਰ ਘੱਟ ਪੜ੍ਹੇ ਲਿਖੇ ਆਦਮੀ ਹਨ ਉਹਨਾਂ ਨੂੰ ਸਿਰਫ਼ ਪੰਜਾਬੀ ਹੀ ਆਉਂਦੀ ਹੈ ਅੱਜ ਕੱਲ੍ਹ ਦੇ ਬੱਚੇ ਤਾਂ ਹਰ ਭਾਸ਼ਾ ਬੋਲ ਲੈਂਦੇ ਹਨ ਪਰ ਪੁਰਾਣੇ ਜ਼ਮਾਨੇ ਦੇ ਬਜ਼ੁਰਗ ਸਿਰਫ ਪੰਜਾਬੀ ਹੀ ਬੋਲਦੇ ਹਨ ਇਸ ਨਾਲ਼ ਬੈਂਕਿੰਗ ਸੈਕਟਰ ਨੂੰ ਵੀ ਬਹੁਤ ਫਾਇਦਾ ਹੋਵੇਗਾ ਜੇਕਰ ਬੈਂਕਿੰਗ ਸੈਕਟਰ ਨੇ ਖੇਤਰੀ ਭਾਸ਼ਾ ਵਿੱਚ ਉਪਲੱਬ ਦਸਤਾਵੇਜ਼ ਉਪਲਬਧ ਕਰਵਾ ਦਿੱਤੇ ਤਾਂ ਉਹਨਾਂ ਨੂੰ ਵੀ ਘਰ ਘਰ ਜਾ ਕੇ ਸਮੱਸਿਆ ਦੂਰ ਕਰਨਾ ਹੱਲ ਹੋ ਜਾਵੇਗਾ ਉਹ ਤਾਂ